ਮੇਰੀ ਬਚਪਨ ਦੀਆਂ ਸਾਰੀਆਂ ਯਾਦਾਂ ਹੀ ਮੇਰੇ ਲਈ ਬਹੁਤ ਮਨਮੋਹਕ ਹਨ ਪਰ ਜੋ ਮੇਰੀ ਬਚਪਨ ਦੀ ਸਭ ਤੋਂ ਮੇਨ ਯਾਦ ਹੈ ਜੋ ਕਿ ਅਸੀਂ ਬਚਪਨ 'ਚ ਗੁੱਡੀਆਂ ਨਾਲ ਅਤੇ ਬਰਤਨਾਂ ਨਾਲ ਖੇਲਦੇ ਹੁੰਦੇ ਸੀਗੇ ਅਸੀਂ ਸਾਰੇ ਹੀ ਜਣੇ ਗੁੱਡੀਆਂ ਦੇ ਕੱਪੜੇ ਬਣਾਉਂਦੇ ਸੀ ਅਤੇ ਇਕੱਠੇ ਬਹਿ ਕੇ ਖੇਲਦੇ ਸੀ ਅਤੇ ਉੱਦਾਂ ਹੀ ਅਸੀਂ ਮਿੱਟੀ ਦੇ ਭਾਂਡੇ ਬਣਾਉਂਦੇ ਸੀ ਉਹਦੇ ਵਿੱਚ ਖਾਣਾ ਬਣਾ ਕੇ ਦੇਖਦੇ ਸੀਗੇ ਅਤੇ ਉਸ ਸਮਾਨ ਨੂੰ ਖਾਣ ਦੀ ਕੋਸ਼ਿਸ਼ ਕਰਦੇ ਸੀ ਅਤੇ ਅੱਜ ਵੀ ਮੈਨੂੰ ਉਹ ਯਾਦਾਂ ਬਹੁਤ ਹੀ ਮੇਰੇ ਲਈ ਬਹੁਤ ਹੀ ਮਹੱਤਵਪੂਰਨ ਹਨ ਅਤੇ ਮੈਂ ਉਹ ਯਾਦਾਂ ਨੂੰ ਸੋਚ ਕੇ ਅੱਜ ਵੀ ਬਹੁਤ ਖੁਸ਼ ਹੁੰਦੀ ਹਾਂ ਉਹ ਯਾਦਾਂ ਮੇਰੇ ਲਈ ਬਹੁਤ ਹੀ ਜ਼ਿਆਦਾ ਮ ਅੱਜ ਵੀ ਬਹੁਤ ਜ਼ਿਆਦਾ ਉਹ ਯਾਦਾਂ ਮੈਨੂੰ ਯਾਦ ਆਉਂਦੀਆਂ ਅਤੇ ਮੈਂ ਚਾਹੁੰਦੀ ਹਾਂ ਸਾਡੀ ਜ਼ਿੰਦਗੀ ਉਹੀ ਪਹਿਲੇ ਵਾਂਗ ਜਿੱਦਾਂ ਅਸੀਂ ਰਲ਼ ਮਿਲ ਕੇ ਖੇਡਦੇ ਸੀ ਹੱਸਦੇ ਸੀ ਉੱਦਾਂ ਹੀ ਹੋ ਜਾਵੇ ਅਤੇ ਜੋ ਵੀ ਸਾਡੀ ਬਚਪਨ ਦੀਆਂ ਯਾਦਾਂ ਸੀ ਮੇਰਾ ਮੇਰੀ ਮਨਮੋਹਕ ਯਾਦ ਉਹੀ ਹੈ ਜਦੋਂ ਅਸੀਂ ਆਪਣੀ ਗੁੱਡੀਆਂ ਨਾਲ਼ ਖੇਲਦੇ ਹੁੰਦੇ ਸੀ